ਜ਼ਮੀਨੀ ਝਗੜੇ ਇਹ ਕਿਸਾਨ ਦੇ ਨਾਲ ਉਦੋਂ ਤੋਂ ਸੰਬੰਧਿਤ ਹਨ ਜਦੋਂ ਤੋਂ ਖੁੱਲ੍ਹੇ ਖੇਤੀ ਦੇ ਢੰਗ ਛੱਡ ਕੇ ਕਬੀਲਦਾਰੀ ਜ਼ਮਾਨਾ ਛੱਡ ਕੇ ਲੋਕ ਸਥਾਈ ਰੂਪ ਵਿੱਚ ਰਹਿਣਾ ਖੇਤੀ ਕਰਨੀ ਅਤੇ ਪਸ਼ੂ ਪਾਲਣ ਸ਼ੁਰੂ ਕੀਤਾ ਉਸ ਤੋਂ ਅੱਜ ਤੱਕ ਇਹ ਝਗੜੇ ਲਗਾਤਾਰ ਕਬੀਲਿਆਂ ਦੇ ਰੂਪ 'ਚ ਸੰਸਥਾਵਾਂ ਦੇ ਰੂਪ 'ਚ ਵਿਅਕਤੀਗਤ ਰੂਪ 'ਚ ਚਲਦੇ ਹੀ ਰਹਿੰਦੇ ਹਨ ਕਿਸੇ ਸਮੇਂ ਵਿੱਚ ਰਾਜਿਆਂ ਦੇ ਰਾਜਾਂ ਵੇਲੇ ਇਹਨਾਂ ਦਾ ਹੱਲ ਰਾਜੇ ਵੱਲੋਂ ਬੋਲੇ ਗਏ ਸ਼ਬਦ ਹੁੰਦੇ ਸਨ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਰਹਿ ਰਹੇ ਹਾਂ ਅਤੇ ਅਦਾਲਤਾਂ ਦੀ ਕਾਰਗੁਜ਼ਾਰੀ ਦੇ ਅਧੀਨ ਨਿਯਮਾਂ ਮੁਤਾਬਿਕ ਇਹਨਾਂ ਝਗੜਿਆਂ ਦੀ ਜਿਹੜੀ ਹੱਲ ਹੈ ਉਹ ਹੁੰਦੇ ਆ ਉਹ ਉਸੇ ਢੰਗ ਨਾਲ ਹੀ ਕੀਤੇ ਜਾਂਦੇ ਆ ਅਸੀਂ ਸਭ ਤੋਂ ਪਹਿਲਾਂ ਜੇ ਕੋਈ ਝਗੜਾ ਪੈਦਾ ਹੁੰਦਾ ਤਾਂ ਵਕੀਲ ਕੋਲ ਅਤੇ ਅਦਾਲਤ ਕੋਲ ਜਾਂਦੇ ਹਾਂ ਸੰਬੰਧਿਤ ਤਹਿਸੀਲਦਾਰ ਸਬ ਡਿਵੀਜ਼ਨ ਮਜਿਸਟ੍ਰੇਟ ਉਹਨਾਂ ਕੋਲ ਜਾਂਦੇ ਹਾਂ ਤਾਂ ਉੱਥੇ ਸਾਨੂੰ ਇੱਕ ਬਹੁਤ ਲੰਬੇ ਅਤੇ ਅਕਾਊ ਪ੍ਰੋਸੀਜਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਇਹ ਜਿਹੜੇ ਪ੍ਰੋਸੀਜਰ ਹੈ ਇਹ ਸਾਰੇ ਕਈ ਵਾਰ ਏਡੇ ਲੰਬੇ ਹੋ ਜਾਂਦੇ ਹੈ ਕਿ ਇੱਕ ਪੀੜ੍ਹੀ ਦੀ ਮੌਤ ਹੋਣ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਵੀ ਲੜਦੀਆਂ ਰਹਿੰਦੀਆਂ ਹਨ ਕੁਝ ਕੇਸਾਂ ਦੇ ਫੈਸਲੇ ਇੱਕ ਸੌ ਵੀਹ ਇੱਕ ਸੌ ਸੱਤਰ ਜਾਂ ਅੱਸੀ ਨੱਬੇ ਸਾਲ ਬਾਅਦ ਹੁੰਦੇ ਹੈ ਇਸ ਤਰ੍ਹਾਂ ਇਹ ਅਦਾਲਤੀ ਸਿਸਟਮ ਬਹੁਤ ਉਲਝਿਆ ਹੋਇਆ ਤਾਣਾ ਬਾਣਾ ਅਤੇ ਕਿਸਾਨੀ ਨੂੰ ਇਹਦੇ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਨੂੰ ਕੋਈ ਨਾ ਕੋਈ ਅਜਿਹੇ ਕਾਰਗਰ ਤਰੀਕੇ ਅਪਣਾਉਣੇ ਚਾਹੀਦੇ ਆ ਕਿ ਇਹ ਸੰਬੰਧਿਤ ਜੋ ਝਗੜੇ ਹੁੰਦੇ ਹੈ ਜੋ ਜ਼ਮੀਨ ਜੋ ਜ਼ਮੀਨ ਨਾਲ ਸੰਬੰਧਿਤ ਝਗੜੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਨਿਪਟਾਇਆ ਜਾਵੇ ਉਦਾਹਰਨ ਦੇ ਤੌਰ 'ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਇੱਕ ਹੁਣੇ ਪਿਛਲੇ ਸਾਲ ਫੈਸਲਾ ਆਇਆ ਕਿ ਜੋ ਖੇਤੀ ਕੋਈ ਵੀ ਸ਼ਾਂਤਮਈ ਢੰਗ ਨਾਲ ਬਾਰ੍ਹਾਂ ਸਾਲ ਤੋਂ ਲਗਾਤਾਰ ਕਰ ਰਿਹਾ ਤਾਂ ਉਹਨੂੰ ਉਸ ਤੋਂ ਕੱਢਿਆ ਨਹੀਂ ਜਾ ਸਕਦਾ ਪਰ ਸਰਕਾਰ ਕਿਉਂ ਇਸ ਫੈਸਲੇ ਦੀ ਲਾਈਟ ਦੇ ਵਿੱਚ ਫੈਸਲਾ ਕਿਉਂ ਨਹੀਂ ਕਰ ਦਿੰਦੀ ਕਿ ਜੋ ਅਜਿਹੀਆਂ ਜ਼ਮੀਨਾਂ ਹਨ ਉਹ ਹੇਠਾਂ ਤਹਿਸੀਲਦਾਰਾਂ ਨੂੰ ਹੁਕਮ ਦਿੱਤੇ ਜਾਣ ਅਤੇ ਉਹ ਖੇਤੀ ਕਰਨ ਵਾਲੇ ਕਾਰਜਕਾਰਾਂ ਦੇ ਨਾਮ ਕੀਤੀਆਂ ਜਾਣ ਇਸ ਤਰ੍ਹਾਂ ਨਾਲ ਸਾਡੇ ਲੋਕ ਇਹਨਾਂ ਝਗੜਿਆਂ ਤੋਂ ਲੰਬੇ ਝਗੜਿਆਂ ਤੋਂ ਬੱਚ ਜਾਣਗੇ ਅਤੇ ਇਹ ਕਾਫੀ ਸਮਾਜ ਦੇ ਵਿੱਚ ਤਣਾਓ ਮੁਕਤੀ ਦਾ ਸਾਧਨ ਬਣਨਗੇ